ਭਾਰਤ ਦੀ ਸਿੱਖਿਆ ਪ੍ਰਣਾਲੀ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਸਿੱਖਿਆ ਪ੍ਰਣਾਲੀ ਬਹੁਤ ਫਾਸਟ ਹੋ ਗਈ ਹੈ ਜੇਕਰ ਮੈਂ ਦੋ ਹਜ਼ਾਰ ਪੰਦਰ੍ਹਾਂ ਤੇਰ੍ਹਾਂ ਬਾਰ੍ਹਾਂ ਦੀ ਗੱਲ ਕਰਾਂ ਤਾਂ ਭਾਰਤ ਦੀ ਸਿੱਖਿਆ ਪ੍ਰਣਾਲੀ ਜਿਹੜੀ ਸਲੋ ਸੀ ਉਦੋਂ ਕਿਉਂਕਿ ਪ੍ਰੈਕਟੀਕਲ ਵੀ ਸਾਨੂੰ ਪੜ੍ਹਾਇਆ ਜਾਂਦਾ ਸੀ ਲੈਬਾਂ ਦੇ ਵਿੱਚ ਕਰਵਾਇਆ ਨਹੀਂ ਜਾਂਦਾ ਸੀਗਾ ਔਨਲੈਨ ਕੋਈ ਵੀ ਸਿਸਟਮ ਨਹੀਂ ਸੀ ਜਿਵੇਂ ਦੋ ਹਜ਼ਾਰ ਵੀਹ ਤੋਂ ਬਾਅਦ ਭਾਰਤ ਦੇ ਵਿੱਚ ਔਨਲਾਇਨ ਸਿਸਟਮ ਹੋ ਗਿਆ ਹੈਗਾ ਸਾਰਾ ਕੁਛ ਔਨਲੈਨ ਅਗਰ ਜਿਵੇਂ ਕਰੋਨਾ ਟਾਈਮ ਦੀ ਵੀ ਗੱਲ ਕਰੀਏ ਵੀ ਬੱਚਿਆਂ ਦੇ ਪੇਪਰ ਵੀ ਔਨਲਾਈਨ ਹੋ ਗਏ ਸੀ ਵੀ ਕਿਸੇ ਦਾ ਕੋਈ ਵੀ ਪ੍ਰੋਸੈਸ ਨਹੀਂ ਕਰਿਆ ਦੂਜਿਆਂ ਦੇਸ਼ਾਂ ਦੇ ਮੁਕਾਬਲੇ ਮੈਂ ਗੱਲ ਕਰਾਂ ਤਾਂ ਉਸਦੇ ਕਲਾਸ ਦੇ ਵਿੱਚ ਸੱਤ ਸਟੂਡੈਂਟ ਦਾ ਇੱਕ ਟੀਚਰ ਹੁੰਦਾ ਸੀ ਅਗਰ ਅਗਰ ਮੈਂ ਭਾਰਤ ਦੀ ਗੱਲ ਕਰਾਂ ਪੰਜਾਬ ਦੀ ਗੱਲ ਕਰਾਂ ਤਾਂ ਸਾਡੀ ਚਾਲੀ ਪੰਤਾਲੀ ਬੱਚਿਆਂ ਦੀ ਕਲਾਸ ਵਿੱਚ ਇੱਕ ਟੀਚਰ ਹੁੰਦਾ ਸੀਗਾ ਪ੍ਰੈਕਟੀਕਲ ਵੀ ਸਾਨੂੰ ਪੜ੍ਹਾਇਆ ਜਾਂਦਾ ਸੀਗਾ ਸਾਡੀ ਦੋ ਹਜ਼ਾਰ ਦਸ ਗਿਆਰ੍ਹਾਂ ਬਾਰ੍ਹਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਦੋਂ ਭਾਰਤ ਦੀ ਸਿੱਖਿਆ ਦੀ ਉਦੋਂ ਉਹ ਬਹੁਤ ਹੌਲੀ ਸੀ ਪਰ ਦੋ ਹਜ਼ਾਰ ਵੀਹ ਤੋਂ ਬਾਅਦ ਇਹ ਜਿਹੜੀ ਸਿੱਖਿਆ ਪ੍ਰਣਾਲੀ ਹੈ ਬਹੁਤ ਤੇਜ਼ ਹੋ ਚੁੱਕੀ ਹੈ ਹੁਣ ਅਸੀਂ ਦੂਜੇ ਦੇਸ਼ਾਂ ਦੇ ਬਰਾਬਰ ਹੀ ਹਾਂ ਸਾਰਾ ਸਿਸਟਮ ਔਨਲਾਈਨ ਹੋ ਗਿਆ ਪੇਪਰ ਔਨਲਾਈਨ ਹੈ ਜੋ ਵੀ ਕੰਪਿਊਟਰ ਦੇ ਜੌਬਸ ਹੋ ਗਏ ਸਾਰਾ ਸਿਸਟਮ ਹੀ ਔਨਲਾਈਨ ਹੈ ਤਾਂ ਹੁਣ ਕਾਫ਼ੀ ਸੁਧਾਰ ਨੇ ਭਾਰਤ ਦੇ ਵਿੱਚ ਤਾਂ ਭਾਰਤ ਦੀ ਸਿੱਖਿਆ ਪ੍ਰਣਾਲੀ ਹੁਣ ਬਹੁਤ ਵਧੀਆ ਹੈ ਜਿਵੇਂ ਛੋਟੇ ਬੱਚਿਆਂ ਦੇ ਗਰਮੀ ਦੀਆਂ ਛੁੱਟੀਆਂ ਪਹਿਲਾਂ ਹੋ ਜਾਣ 'ਤੇ ਉਹਨਾਂ ਨੂੰ ਔਨਲਾਈਨ ਹੀ ਸਿਲੇਬਸ ਭੇਜਿਆ ਜਾਂਦਾ ਔਨਲਾਈਨ ਹੀ ਕੰਮ ਦਿਤ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਪਹਿਲਾਂ ਆਉਂਦੀ ਸੀ ਪਰ ਦੋ ਹਜ਼ਾਰ ਵੀਹ ਤੋਂ ਬਾਅਦ ਹੁਣ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੁਣ ਭਾਰਤ ਦੀ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਹੈ ਥੈਂ ਧੰਨਵਾਦ